ਸਰਕਾਰੀ ਸਕੀਮਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਗੋਰਮੈਂਟ ਦੀ ਆਯੂਸ਼ਮਾਨ ਸਕੀਮ ਹੈ ਜਿਸ ਦਾ ਸਾਨੂੰ ਬਹੁਤ ਲਾਭ ਮਿਲ ਰਿਹਾ ਹੈ ਇਹ ਕਾਫੀ ਚੰਗੀ ਸਕੀਮ ਹੈ ਜਿਸ ਜਿਸ ਨਾਲ ਕਿ ਪੰਜ ਲੱਖ ਤੱਕ ਤੱਕ ਦਾ ਇਲਾਜ ਮੁਫਤ ਮਿਲ ਜਾਂਦਾ ਹੈ ਇਹ ਏਦਾਂ ਹੋਇਆ ਸੀਗਾ ਕਿ ਇੱਕ ਵਾਰ ਐਕਸ ਐਕਸੀਡੈਂਟ ਦੇ ਦੌਰਾਨ ਹੋਸਪੀਟਲ ਵਿੱਚ ਜਾਣਾ ਪਿਆ ਸੀ ਪਰ ਉੱਥੇ ਕਾਫੀ ਪੈਸੇ ਲੱਗ ਜਾਣੇ ਸੀ ਪਰ ਇਸ ਸਕੀਮ ਦੀ ਮਦਦ ਨਾਲ ਉਹ ਅਸਾਨੀ ਨਾਲ ਹੋ ਗਿਆ ਸੀ